ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਸਭ ਤੋਂ ਮੇਨ ਕਾਰਨ ਇਹ ਹੈ ਕਿ ਵੀ ਉਹਨਾਂ ਦੀ ਈਗੋ ਈਗੋ ਐਡਾ ਬੜਾ ਇਸ਼ੂ ਬਣ ਚੁੱਕਿਆ ਆ ਕਿਉਂਕਿ ਬੱਚੇ ਇਸਨੂੰ ਲੈ ਕੇ ਕੁਝ ਹੋਰ ਸੋਚ ਹੀ ਨਹੀਂ ਰਹੇ ਅਗਰ ਕਿਸੇ ਬੱਚੇ ਨੇ ਬੀਕੌਮ ਕੀਤੀ ਹੋਈ ਆ ਉਹਦਾ ਇਹ ਹੀ ਮੇਨ ਮੋਟਿਵ ਤਾਂ ਇਹ ਹੀ ਰਹਿੰਦਾ ਆ ਵੀ ਉਹਨੂੰ ਵੀਹ ਪੱਚੀ ਹਜ਼ਾਰ ਦੀ ਜੋਬ ਮਿਲ ਜਾਵੇ ਪੰਦਰਾਂ ਹਜ਼ਾਰ ਦੀ ਜੋਬ ਮਿਲ ਜਾਵੇ ਜੀ ਸਾਡੇ ਦਸ ਹਜ਼ਾਰ ਦੇ ਵਿੱਚ ਖਰਚੇ ਨਹੀਂ ਪੂਰੇ ਹੁੰਦੇ ਹੈਗੇ ਸਾਡੇ ਦਸ ਹਜ਼ਾਰ 'ਚ ਖਰਚੇ ਨਹੀਂ ਪੂਰੇ ਹੁੰਦੇ ਪੰਦਰਾਂ ਹਜ਼ਾਰ 'ਚ ਖਰਚੇ ਨਹੀਂ ਪੂਰੇ ਹੁੰਦੇ ਸਾਨੂੰ ਦੂਰ ਪੈਂਦਾ ਆ ਸਾਨੂੰ ਨੇੜੇ ਪੈਂਦੀ ਹੈ ਇਹ ਜੋਬ ਮਤਲਬ ਸਾ ਬਹੁਤ ਸਾਰੀਆਂ ਜੋਬਸ ਨੇ ਪ੍ਰਾਈਵੇਟਸ ਸੈਕਟਰ ਦੇ ਵਿੱਚ ਜੋਬਸ ਇੰਨੀਆਂ ਜ਼ਿ ਇੰਨੀਆਂ ਕੁ ਜ਼ਿਆਦਾ ਨੇ ਹਰ ਕੋਈ ਬੱਚਾ ਟਵੈਲਥ ਪਾਸਿੰਗ ਬੱਚਾ ਵੀ ਜੋਬ ਕਰ ਸਕਦਾ ਆ ਬਟ ਕੀ ਕਰੀਏ ਉਹਨਾਂ ਦਾ ਮਾਨਸਿਕ ਸੰਤੁਲਨ ਐਵੇਂ ਦਾ ਬਣਿਆ ਹੋਇਆ ਹੈਗਾ ਵੀ ਮਾ ਮਾਨਸਿਕ ਸਥਿਤੀ ਐਵੇਂ ਦੀ ਬਣੀ ਹੋਈ ਆ ਵੀ ਜੇ ਅਸੀਂ ਦਸ ਹਜ਼ਾਰ ਵਾਲੀ ਜੋਬ ਨਹੀਂ ਕਰਨੀ ਈਵਨ ਕਿ ਮੈਂ ਵੀ ਅ ਬੀਕੌਮ ਐੱਮਕੌਮ ਕੀਤੀ ਹੋਈ ਆ ਹੁਣ ਮੈਂ ਐਜ਼ ਆ ਟਰੇਨਰ ਕੰਮ ਕਰਦੀ ਹਾਂ ਬਟ ਜਦੋਂ ਮੈਂ ਜੋਬ ਸਟਾਰਟ ਹੋਈ ਸੀ ਉਦੋਂ ਮੇਰੀ ਪੰਜ ਹਜ਼ਾਰ 'ਤੇ ਜੋਬ ਸਟਾਰਟ ਹੋਈ ਸੀਗੀ ਅਤੇ ਮੈਨੂੰ ਪਤਾ ਸੀਗਾ ਵੀ ਮੈਂ ਆਪ ਕੁਛ ਬਣਨਾ ਹੈ ਹੈ ਅੱਗੇ ਕੁਛ ਕਰਨਾ ਹੈਗਾ ਅਤੇ ਹਨਾ ਹੌਲੀ ਹੌਲੀ ਸਾਰਾ ਕੁਛ ਇੰਪਰੂਵ ਹੋਈ ਜਾਂਦਾ ਆ ਜਦੋਂ ਸਟਾਰਟਿੰਗ ਸੀ ਉਦੋਂ ਪੰਜ ਹਜ਼ਾਰ ਜੋਬ ਹੋਈ ਫਿਰ ਅੱਠ ਹਜ਼ਾਰ ਹੋਈ ਸੈਲਰੀ ਫਿਰ ਦਸ ਹਜ਼ਾਰ ਹੋਈ ਫਿਰ ਬਾਰਾਂ ਹਜ਼ਾਰ ਹੋਈ ਸੈਲਰੀ ਫਿਰ ਹੌਲੀ ਹੌਲੀ ਐਵੇਂ ਹੀ ਇਨਕ੍ਰੀਜ਼ ਹੁੰਦੀ ਗਈ ਇਹਦੇ ਨਾਲ ਕੀ ਆ ਵੀ ਮੇਰੇ ਮਨ ਦੇ ਵਿੱਚ ਇੱਛਾ ਸੀਗੀ ਵੀ ਹਾਂ ਮੈਂ ਜੋਬ ਕਰਨੀ ਆ ਅਤੇ ਮੈਂ ਕੁਛ ਬਣਨਾ ਹੈਗਾ ਅੱਗੇ ਹੁਣ ਅੱਧੇ ਨੌਜਵਾਨਾਂ ਦੇ ਬੇਰੁਜ਼ਗਾਰੀ ਦਾ ਮੇਨ ਕਾਰਨ ਇਹ ਹੀ ਆ ਵੀ ਬੱਚੇ ਸੋਚਦੇ ਨੇ ਵੀ ਸਾਨੂੰ ਦਸ ਹਜ਼ਾਰ ਦੀ ਜੋਬ ਨਹੀਂ ਕਰਨੀ ਅਸੀਂ ਪੰਦਰਾਂ ਹਜ਼ਾਰ ਦੀ ਜੋਬ ਨਹੀਂ ਕਰਨੀ ਅਸੀਂ ਸਾਨੂੰ ਪੰਦਰਾਂ ਹਜ਼ਾਰ ਦੀ ਜੋਬ ਤੋਂ ਵੱਧ ਚਾਹੀਦੀ ਆ ਸੈਲਰੀ ਸਾਨੂੰ ਵੀਹ ਹਜ਼ਾਰ ਦੀ ਜੋਬ ਚਾਹੀਦੀ ਹੈ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਸਿਰਫ ਪਲੱਸ ਟੂ ਸੋਚਦੇ ਤੁਸੀਂ ਐਵੇਂ ਹੋ ਵੀ ਸਾਨੂੰ ਪੱਚੀ ਤੀਹ ਹਜ਼ਾਰ ਦੀ ਜੋਬ ਮਿਲ ਜੇ ਇਹ ਵੀ ਤਾਂ ਇੱਕ ਬੇਰੁਜ਼ਗਾਰੀ ਦਾ ਕਾਰਨ ਹੀ ਆ ਪਲੱਸ ਟੂ ਤੋਂ ਬਾਅਦ ਬੱਚੇ ਅੱਗੇ ਪੜ੍ਹ ਨਹੀਂ ਰਹੇ ਕਿਉਂਕਿ ਘਰ ਦੀਆਂ ਕੰਡੀਸ਼ਨਸ ਐਵੇਂ ਦੀਆਂ ਹੈ ਨਹੀਂ ਗੀਆਂ ਕਿਉਂਕਿ ਕ ਦਿਨ ਬ ਦਿਨ ਮਹਿੰਗਾਈ ਇੰਨੀ ਜ਼ਿਆਦਾ ਵਧੀ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਉਹ ਪਲੱਸ ਟੂ ਤੋਂ ਬਾਅਦ ਇੰਨਾ ਨਹੀਂ ਪੜ੍ਹਾ ਪਾਉਂਦੇ ਜਾਂ ਕਈਆਂ ਦੇ ਪੜਾਉਂਦੇ ਨੇਗੇ ਉਹਨੇ ਬੀ ਟੈਕ ਕੀਤੀ ਹੋਈ ਆ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਕਿਤੇ ਵਧੀਆ ਤਰੀਕੇ ਨਾਲ ਕੀ ਨੇ ਉਹ ਬੇਰੁਜ਼ਗਾਰੀ ਓ ਆ ਸਾਰੀ ਬੇਰੁਜ਼ਗਾਰੀ ਫੈਲੀ ਜਾਂਦੀ ਆ ਤਾਂ ਹੁਣ ਇੱਕ ਪੇ ਬੱਚੇ ਦੇ ਪੇਰੈਂਟਸ ਨੇ ਬੀ ਟੈਕ ਕੀਤੀ ਆ ਬੱਚੇ ਨੇ ਇੰਨਾ ਪੈਸਾ ਖਰਚ ਕੀਤਾ ਘਰ ਦੇ ਹਾਲਾਤ ਵੀ ਇੰਨੇ ਮਾੜੇ ਸੀਗੇ ਬਟ ਫਿਰ ਵੀ ਉਹਦੇ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਸਮਝਾਇਆ ਪੜ੍ਹਾਇਆ ਅਤੇ ਉਹਨਾਂ ਦੀ ਬੀ ਟੈਕ ਕਰਵਾ ਤੀ ਉਸ ਤੋਂ ਬਾਅਦ ਕੀ ਹੋਇਆ ਵੀ ਬੱਚੇ ਨੇ ਕੀ ਕੀਤਾ ਉਹਨੂੰ ਜੋਬ ਨਹੀਂ ਮਿਲੀ ਹੈਗੀ ਉਹ ਸੈਟਿਸਫਾਈ ਨਹੀਂ ਸੀ ਉਹ ਜੋਬ ਤੋਂ ਉਹਨੇ ਆਪਣੇ ਮੰਮਾ ਦੀ ਚੁੰਨੀ ਚੱਕੀ ਅਤੇ ਗਲ ਫਾਹਾ ਲੈ ਲਿਆ ਸੇਮ ਇੱਕ ਬੱਚਾ ਹੋਰ ਸੀਗਾ ਉਹਨੇ ਉਹਦੇ ਵੀ ਘਰ ਦੇ ਹਾਲਾਤ ਮਾੜੇ ਸੀਗੇ ਬੀ ਟੈਕ ਕੀਤੀ ਉਹਨੇ ਅਤੇ ਉਹਦਾ ਕੀ ਸੀ ਉਹਨੇ ਬੀ ਟੈਕ ਕੀਤੀ ਬਟ ਉਹਨੇ ਬੀ ਟੈਕ ਕਰਨ ਤੋਂ ਬਾਅਦ ਦੇਖਿਆ ਘਰ ਦੇ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਉਹਨੇ ਕੁਛ ਇੰਨੀ ਕੁ ਕੋਸ਼ਿਸ਼ ਕੀਤੀ ਕਿ ਉਹਨੇ ਜਦੋਂ ਫਸਟ ਜੋਬ ਸਟਾਰਟ ਕੀਤੀ ਸੀ ਇੱਕ ਪੀਅਨ ਦੀ ਜੋਬ ਤੋਂ ਸਟਾਰਟ ਕੀਤੀ ਸੀ ਹੌਲੀ ਹੌਲੀ ਇੰਪਰੂਵ ਕੀਤਾ ਕਰਦਾ ਗਿਆ ਬੀ ਟੈਕ ਕੀਤੀ ਐੱਮ ਬੀ ਏ ਕੀਤੀ ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਅ ਉਹ ਬੱਚਾ ਅੱਜ ਮੈਨੇਜਰ ਦੀ ਪੋਸਟ 'ਤੇ ਆ ਹੁਣ ਇਹਦੇ ਵਿੱਚ ਫਰਕ ਇਹੀ ਆ ਵੀ ਸਰਕਾਰਾਂ ਬਹੁਤ ਐਫਰਟਸ ਲਗਾ ਰਹੀਆਂ ਨੇ ਆਪਣੇ ਵੀ ਹਾਂ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ ਬਟ ਕੀ ਕਰੀਏ ਬੱਚੇ ਉਹਨਾਂ ਨਾਲ ਕੋਪਰੇਟ ਨਹੀਂ ਕਰ ਰਹੇ ਸਹਿਯੋਗ ਨਹੀਂ ਦੇ ਪ ਦੇ ਰਹੇ ਬੱਚੇ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਨੀਆਂ ਜੋਬਜ਼ ਨੇ ਗੀਆਂ ਗੌਰਮੈਂਟ ਸੈਕਟਰ ਦੀ ਤਿਆਰੀ ਕਰ ਸਕਦੇ ਨੇ ਗੌਰਮੈਂਟ ਪੇਪਰ ਕਲੀਅਰ ਕਰਨਗੇ ਬੱਚੇ ਪੇਪਰ ਕਿਵੇਂ ਕਲੀਅਰ ਕਰਨਗੇ ਅਗਰ ਉਹਨਾਂ ਕੋਲ ਐਜੂਕੇਸ਼ਨ ਹੋਏਗੀ ਐਜੂਕੇਸ਼ਨ ਵੱਲ ਧਿਆਨ ਹੋਊਗਾ ਪੜ੍ਹਾਈ ਵੱਲ ਧਿਆਨ ਹੋਊਗਾ ਹੁਣ ਬੱਚੇ ਉਨਾ ਧਿਆਨ ਦੇ ਨਹੀਂ ਰਹੇ ਜਿੰਨਾ ਪਹਿਲਾਂ ਦੇ ਰਹੇ ਸੀਗੇ ਉਹਨਾਂ ਨੂੰ ਤਾਂ ਪੜ੍ਹਾਈ ਵੱਲ ਵੀ ਧਿਆਨ ਦੇਣ ਦੀ ਲੋੜ ਆ ਅਤੇ ਪ੍ਰਾਈਵੇਟ ਸੈਕਟਰ ਦੀਆਂ ਜਿਹੜੀਆਂ ਵੀ ਜੋਬਜ਼ ਹੁੰਦੀਆਂ ਨੇ ਉਹਨਾਂ ਨੂੰ ਆਪਣਾ ਨਾਲ ਦੀ ਨਾਲ ਜੋਬਜ਼ ਕਰਨੀਆਂ ਚਾਹੀਦੀਆਂ ਨੇ ਸੈਲਰੀ ਜਦੋਂ ਲੱਗਾਂਗੇ ਉਦੋਂ ਤਾਂ ਘੱਟ ਹੋਊਗੀ ਮੰਨਦੇ ਹਾਂ ਬਟ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਜੋਬਸ ਕਰਨੀਆਂ ਚਾਹੀਦੀਆਂ ਨੇ ਨਹੀਂ ਤਾਂ ਵਿਹਲੇ ਬੈਠੇ ਨੇ ਬੀ ਕੌਮ ਕੀਤੀ ਹੋਈ ਆ ਕਿਸੇ ਨੇ ਬੀ ਏ ਕੀਤੀ ਹੋਈ ਆ ਗਰੈਜੂਏਸ਼ਨ ਕੀਤੀ ਹੋਈ ਆ ਮਾਸਟਰਜ਼ ਕੀਤੀ ਹੋਈ ਆ ਬੀ ਟੈਕ ਕੀਤੀ ਹੋਈ ਆ ਬੱਚੇ ਐਵੇਂ ਹੀ ਘਰ ਬੈਠੇ ਨੇ ਕਹਿ ਦਿੰਦੇ ਆ ਅਸੀਂ ਗਵਰਮੈਂਟ ਪੇਪਰ ਦੀ ਤਿਆਰੀ ਕਰਦੇ ਹਾਂ ਨਹੀਂ ਗਵਰਮੈਂਟ ਪੇਪਰ ਦੀ ਨਾਲ ਦੀ ਨਾਲ ਤਿਆਰੀ ਕਰੋ ਤੁਸੀਂ ਜੋਬ ਦਾ ਐਕਸਪੀਰੀਅੰਸ ਲਓ ਅੱਧੀਆਂ ਚੀਜ਼ਾਂ ਤੋਂ ਉੱਥੇ ਹੀ ਕਲੀਅਰ ਹੋਣ ਲੱਗ ਜਾਂਦੀਆਂ ਨੇ ਜਦੋਂ ਤੁਸੀਂ ਗੌਰਮੈਂਟ ਪੇਪਰ ਤਿਆਰ ਕਰਨਾ ਤੁਸੀਂ ਅ ਈਕੋਨਮੀ ਦੇ ਵਿੱਚ ਸਰਵਾਈਵ ਕਰੋਗੇ ਤੁਹਾਨੂੰ ਪਤਾ ਲੱਗੂਗਾ ਵੀ ਅੱਜ ਕੰਡੀਸ਼ਨ ਕੀ ਆ ਕੱਲ੍ਹ ਨੂੰ ਕੀ ਆ ਉਹਦੇ ਨਾਲ ਕੀ ਆ ਤੁਹਾਡੇ ਬਹੁਤ ਸਾਰੇ ਜਿਹੜੇ ਉਹ ਬਹੁਤ ਸਾਰੇ ਹੁੰਦੇ ਨੇਗੇ ਆਪਣੇ ਵਿਚਾਰ ਉਹ ਸਾਂਝੇ ਹੁੰਦੇ ਨੇ ਲੋਕਾਂ ਦੇ ਪਤਾ ਲੱਗਦਾ ਹੈਗਾ ਵੀ ਹਾਂ ਲੋਕ ਕਿਸ ਚੀਜ਼ ਬਾਰੇ ਕੀ ਸੋਚ ਰਹੇ ਨੇ ਉਹਨਾਂ ਦੇ ਉਹਦੇ ਨਾਲ ਕੀ ਆ ਆਪਾਂ ਆਪਣੇ ਗਵਰਮੈਂਟ ਪੇਪਰ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਪਾਂ ਕਲੀਅਰ ਕਰ ਸਕਦੇ ਆ ਉਸ ਜੋਬ ਗਵਰਮੈਂਟ ਪੇਪਰ ਨੂੰ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬਹੁਤ ਸਾਰੀਆਂ ਜੋਬਸ ਨੇਗੀਆਂ ਉਹਨਾਂ ਨਾਲ ਆਪਾਂ ਬੇਰੁਜ਼ਗਾਰੀ ਨੂੰ ਖਤਮ ਕਰ ਸਕਦੇ ਹਾਂ ਬਟ ਅੱਜ ਦੇ ਨੌਜਵਾਨਾਂ ਦੇ ਵਿੱਚ ਉਹ ਜੋਸ਼ ਖ਼ਤਮ ਹੋ ਚੁੱਕਿਆ ਆ ਕਿਉਂਕੀ ਸਾਰੇ ਬੱਚੇ ਨੇ ਜਿਹੜੇ ਉਹ ਨਸ਼ੇ ਦੇ ਪਿੱਛੇ ਲੱਗ ਚੁੱਕੇ ਨੇ ਉਹਨਾਂ ਨੂੰ ਇੰਨਾ ਹੈ ਨੀਗਾ ਘਰ ਦੇ ਪੈਸੇ ਦੇ ਰਹੇ ਨੇ ਠੀਕ ਆ ਘਰਦਿਆਂ ਕੋਲੋਂ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਘਰ ਲੜਾਈ ਕਰਕੇ ਜਾਂ ਕੁਛ ਵੀ ਨਸ਼ਾ ਕਰਕੇ ਕੁਛ ਪਤਾ ਹੀ ਨਹੀਂ ਲੱਗਦਾ ਹੈਗਾ ਪੇਰੈਂਟਸ ਨੂੰ ਤੰਗ ਕਰਦੇ ਨੇਗੇ ਪ ਪੇਰੈਂਟਸ ਤੋਂ ਪੈਸੇ ਲੈਂਦੇ ਨੇਗੇ ਅਸੀਂ ਫੀਸਾਂ ਭਰਨੀਆਂ ਨੇ ਕੋਲਜ ਦੀਆਂ ਅਸੀਂ ਐਵੇਂ ਕਰਨਾ ਉਵੇਂ ਕਰਨਾ ਹੈਗਾ ਸਾਡੇ ਆ ਆ ਖਰਚੇ ਨੇਗੇ ਉਹਨਾਂ ਨੂੰ ਕਰਨ ਦੇ ਲਈ ਘਰ ਦੇ ਪੈਸੇ ਦੇ ਦਿੰਦੇ ਨੇ ਪਰ ਅੱਗੋਂ ਕੀ ਕਰਦੇ ਨੇ ਉਹ ਨਸ਼ੇ ਕਰਦੇ ਨੇਗੇ ਜਿਹਦੇ ਨਾਲ ਕੀ ਆ ਉਹ ਕੰਮ ਵੱਲ ਧਿਆਨ ਨੀ ਦੇ ਪਾਉਂਦੇ ਇਹ ਹੀ ਮੇ ਮੇਨ ਰੀਜ਼ਨ ਇਹ ਬੇਰੋਜ਼ਗਾਰੀ ਦਾ ਕਿ ਬੱਚੇ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਦੇ ਵਿੱਚ ਇੰਨੀ ਕੁ ਈਗੋ ਆ ਚੁੱਕੀ ਆ ਉਹਨਾਂ ਨੂੰ ਐਵੇਂ ਹੋਇਆ ਪਿਆ ਆ ਵੀ ਅਸੀਂ ਵੀਹ ਪੱਚੀ ਹਜ਼ਾਰ ਦੀ ਜੋਬ ਨਹੀਂ ਲੱਗਣਾ ਲੱਗਣਾ ਆ ਅਸੀਂ ਦਸ ਪੰਦਰਾਂ ਹਜ਼ਾਰ ਵਾਲੀ ਜੋਬ ਨਹੀਂ ਲੱਗਣਾ ਕਿਉਂਕਿ ਸਾਡੇ ਖਰਚੇ ਨੇ ਜਿਹੜੇ ਉਹ ਪੂਰੇ ਨਹੀਂ ਹੋ ਪਾ ਰਹੇ ਸਰਕਾਰਾਂ ਬਹੁਤ ਐਫਰਟਸ ਕਰ ਸਕਦੀਆਂ ਨੇ ਮਤਲਬ ਜੇ ਸਰਕਾਰ ਦਾ ਮੇਨ ਮੋ ਮੋਟਿਵ ਤਾਂ ਇਹ ਹੀ ਹੋਣਾ ਚਾਹੀਦਾ ਵੀ ਪੰਜਾ ਦੇਸ਼ ਦੇ ਵਿੱਚੋਂ ਨਸ਼ੇ ਨੂੰ ਖ਼ਤਮ ਕੀਤਾ ਜਾਵੇ ਜਦੋਂ ਤੱਕ ਨਸ਼ਾ ਖ਼ਤਮ ਨਹੀਂ ਹੋਊਗਾ ਬੱਚੇ ਆਪਣਾ ਧਿਆਨ ਨਹੀਂ ਲਗਾ ਸਕਦੇ ਪੜ੍ਹਾਈ ਵੱਲ ਅਤੇ ਸਿੱਖਿਆ ਦੇ ਖੇਤਰ ਵਿੱਚ ਇੰਨਾ ਕੁ ਧਿਆਨ ਦੇਣ ਦੀ ਲੋੜ ਆ ਸਰਕਾਰ ਨੂੰ ਕਿ ਬੱਚੇ ਨੂੰ ਫਸਟ ਕਲਾਸ ਤੋਂ ਲੈ ਕੇ ਹੀ ਬੱਚੇ ਨੂੰ ਇੰਨਾ ਕੁ ਸ਼ਾਰਪ ਮਾਇੰਡ ਕੀਤਾ ਜਾਵੇ ਉਹਨਾਂ ਦਾ ਅ ਸਕੂ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਜ਼ ਇੰਨੇ ਵਧੀਆ ਹੋਣੇ ਚਾਹੀਦੇ ਨੇ ਤਾਂ ਜੋ ਉਹ ਵਧੀਆ ਤਰੀਕੇ ਨਾਲ ਪੜ੍ਹਾ ਸਕਣ ਪਰ ਮੈਂ ਜਿੱਥੋਂ ਤੱਕ ਮੈਂ ਆਪਣਾ ਸਰਵੇ ਮੇਰਾ ਸਰਵੇ ਇਹ ਕਹਿੰਦਾ ਆ ਵੀ ਆਹ ਲਾਸਟ ਦੇ ਪੰਜ ਸ਼ ਸਾਲ ਹੋ ਗਏ ਮੈਂ ਪੰਜ ਸਾਲਾਂ ਤੋਂ ਇਹੀ ਚੀਜ਼ ਨੋਟ ਕਰ ਰਹੀ ਹਾਂ ਕਿ ਫਸਟ ਕਲਾਸ ਤੋਂ ਲੈ ਕੇ ਟੈਂਥ ਕਲਾਸ ਦੇ ਬੱਚੇ ਦਾ ਪੰਜਾਬੀ ਬੋਲਣੀ ਤੱਕ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਪੜ੍ਹਨੀ ਤੱਕ ਨਹੀਂ ਆਉਂਦੀ ਕਿਉਂਕਿ ਉਹਨਾਂ ਦਾ ਬੇਸ ਕਲੀਅਰ ਨਹੀਂ ਹੈਗਾ ਉਹਨਾਂ ਨੂੰ ਕੀ ਆਊਗਾ ਪਲੱਸ ਮਾਈਨ ਦੇ ਕੁ ਮਾਈਨਸ ਦੇ ਕੁਸ਼ਚਨਜ਼ ਹੁੰਦੇ ਨੇ ਜਿਹੜੇ ਉਹ ਵੀ ਨਹੀਂ ਆ ਰਹੇ ਬੱਚਿਆਂ ਨੂੰ ਇਹ ਹੀ ਆ ਮੇਨ ਮੇਨ ਬੇਰੁਜ਼ਗਾਰੀ ਦਾ ਕਾਰਨ ਕਿ ਬੱਚਿਆਂ ਦੀਆਂ ਜਿਹੜੀਆਂ